ਸਤਿ ਸ਼੍ਰੀ ਅਕਾਲ ਸਾਰੇ ਜਣਿਆਂ ਨੂੰ ਮੈਂ ਤੁਹਾਨੂੰ ਸਾਰਿਆਂ ਜਣਿਆਂ ਦਾ ਚਾਹਾਂਗਾ ਵੀ ਹਰ ਇੱਕ ਭਾਸ਼ਾ ਦਾ ਜਿਹੜਾ ਵਾ ਉਹ ਆਪਣਾ ਹੀ ਜਿਹੜਾ ਵਾ ਉਹ ਅੰਦਾਜ਼ ਹੁੰਦਾ ਵਾ ਹਰ ਇੱਕ ਭਾਸ਼ਾ ਜਿਹੜੀ ਵਾ ਉਹ ਆਪਣੀ ਆਪਣੀ ਮਹੱਤਤਾ ਜਿਹੜੀ ਹੈ ਉਹ ਰੱਖਦੀ ਆ ਪੰਜਾਬ ਦੇ ਵਿੱਚ ਜੇ ਗੱਲ ਕੀਤੀ ਜਾਏ ਤਾਂ ਪੰਜਾਬੀ ਭਾਸ਼ਾ ਜਿਹੜੀ ਆ ਉਹ ਦੇਖਣ ਨੂੰ ਮਿਲਦੀ ਆ ਹਰ ਖਿੱਤੇ ਦੇ ਵਿੱਚ ਹਰ ਖੇਤਰ ਦੇ ਵਿੱਚ ਥੋੜ੍ਹੇ ਥੋੜ੍ਹੇ ਤੁਸੀਂ ਫਰਕ 'ਤੇ ਡਿਸਟੈਂਸ 'ਤੇ ਜਦੋਂ ਤੁਸੀਂ ਜਾਓਗੇ ਤੁਸੀਂ ਥੋੜ੍ਹੀ ਥੋੜ੍ਹੀ ਦੂਰੀ 'ਤੇ ਜਾਓਗੇ ਤੁਸੀਂ ਇੱਥੇ ਪੰਜਾਬੀ ਭਾਸ਼ਾ ਦੇ ਵਿੱਚ ਵੀ ਤੁਹਾਨੂੰ ਜਿਹੜੀ ਆ ਉਹ ਕਾਫੀ ਜ਼ਿਆਦਾ ਜਿਹੜੀ ਆ ਉਹ ਦੇਖਣ ਨੂੰ ਮਿਲੇਗਾ ਵੀ ਫਰਕ ਵੇਖਣ ਨੂੰ ਮਿਲੇਗਾ ਇੱਕੋ ਜਿੱਕੀ ਜਿਹੜੀ ਹੈ ਪੰਜਾਬੀ ਭਾਸ਼ਾ ਜਿਹੜੀ ਆ ਉਹ ਦੇਖਣ ਨੂੰ ਤੁਹਾਨੂੰ ਨਹੀਂ ਮਿਲੇਗੀ ਅਕਸਰ ਹੀ ਆਪਾਂ ਲੋਕ ਕਹਿ ਦਿੰਦੇ ਵੀ ਪੰਜਾਬੀ ਪੰਜਾਬੀ ਬੋਲਦਾ ਵਾ ਪਰ ਪੰਜਾਬੀ ਭਾਸ਼ਾ ਦੇ ਵਿੱਚ ਵੀ ਅੱਗੋਂ ਵੇਖਿਆ ਜਾਏ ਹੋਰ ਵੀ ਕਾਫੀ ਜ਼ਿਆਦਾ ਗਹਿਰਾਈ ਦੇ ਵਿੱਚ ਹੋਰ ਵੀ ਤਰ੍ਹਾਂ ਵੱਖ ਵੱਖ ਖੇਤਰ ਦੇ ਵਿੱਚ ਜਿਹੜਾ ਉਹਨਾਂ ਦੇ ਵਿੱਚ ਵੇਖਣ ਨੂੰ ਬੋਲਣ ਨੂੰ ਸੁਣਨ ਦੇ ਵਿੱਚ ਜਿਹੜਾ ਵਾ ਉਹ ਫਰਕ ਤੁੁਹਾਨੂੰ ਦੇਖਣ ਨੂੰ ਆਰਾਮ ਨਾਲ ਜਿਹੜਾ ਵਾ ਉਹ ਮਹਿਸੂਸ ਹੁੰਦਾ ਵਾ ਜੇ ਪੰਜਾਬੀ ਭਾਸ਼ਾ ਦੇ ਵਿੱਚ ਮਾਝਾ ਦੁਆਬਾ ਮਾਲਵਾ ਇਹਨਾਂ ਵੱਖ ਵੱਖ ਖੇ ਖੇਤਰਾਂ ਦੇ ਵਿੱਚ ਜਿਹੜੇ ਆ ਉਹ ਵੱਖ ਵੱਖ ਤਰੀਕੇ ਦੇ ਨਾਲ ਜਿਹੜੀਆਂ ਭਾਸ਼ਾ ਜਿਹੜੀ ਆ ਪੰਜਾਬੀ ਨੂੰ ਜਿਹੜਾ ਵਾ ਉਹ ਬੋਲਿਆ ਜਾਂਦਾ ਵਾ ਬਾਕੀ ਹੋਰ ਭਾਸ਼ਾਵਾਂ ਦੇ ਨਾਲ ਪੰਜਾਬੀ ਭਾਸ਼ਾ ਦੀ ਜੇ ਤੁਲਨਾ ਦੀ ਮੈਂ ਗੱਲ ਕਰਦਾ ਹਾਂ ਤਾਂ ਪੰਜਾਬੀ ਭਾਸ਼ਾ ਜਿਹੜੀ ਆ ਉਹ ਉਹਦਾ ਇੱਕ ਆਪਣਾ ਵਜ਼ੂਦ ਵਾ ਬਾਕੀ ਜਿਹੜੀ ਭਾਸ਼ਾ ਅਸੀਂ ਜਾਣਦੇ ਹਾਂ ਜਿਹਦੇ ਵਿੱਚ ਹਿੰਦੀ ਭਾਸ਼ਾ ਆ ਜਾਂਦੀ ਆ ਅਤੇ ਇੰਗਲਿਸ਼ ਭਾਸ਼ਾ ਆ ਜਾਂਦੀ ਆ ਅੰਗਰੇਜ਼ੀ ਜਿਹਨੂੰ ਕਹਿੰਦੇ ਹਾਂ ਅਸੀਂ ਉਹਦਾ ਨਾ ਜਿਹੜਾ ਵਾ ਉਹ ਆਪਣਾ ਮਹੱਤਵ ਆ ਪਰ ਕਈ ਥਾਵਾਂ ਕਈ ਅਕਸ਼ਰ ਜਿਹੜੇ ਆ ਉਹ ਹਿੰਦੀ ਦੇ ਜਿਹੜੇ ਆ ਅਤੇ ਪੰਜਾਬੀ ਦੇ ਜਿਹੜੇ ਆ ਉਹ ਜਿਹੜੇ ਆ ਉਹ ਕਾਫੀ ਜਿਹੜੇ ਆ ਇੱਕ ਦੂਸਰੇ ਦੇ ਨਾਲ ਜਿਹੜੇ ਸਮਾਨਤਾ ਰੱਖਦੇ ਆ ਜਿੱਦਾਂ ਕਿ ਕਾਰ ਘਰ ਇੱਦਾਂ ਦੇ ਕਈ ਵੀ ਹੋਰ ਇੱਦਾਂ ਦੇ ਅਕਸ਼ਰ ਹੈਗੇ ਆ ਜਿਹੜੇ ਕਿ ਇੱਕ ਦੂਸਰੇ ਦੇ ਨਾਲ ਜਿਹੜੇ ਆ ਉਹ ਸਿਮੀਲਰ ਜਿਹੜੇ ਆ ਹੈਗੇ ਆ ਇੱਕ ਦੂਸਰੇ ਦੇ ਨਾਲ ਜਿਹੜੇ ਆ ਮੇਲ ਖਾਂਦੇ ਜਿਹੜੇ ਆ ਉਹ ਸ਼ਬਦ ਹੈ ਜਿਹੜੇ ਪੰਜਾਬੀ ਭਾਸ਼ਾ ਦੇ ਆ ਅਤੇ ਜਿਹੜੇ ਹਿੰਦੀ ਭਾਸ਼ਾ ਦੇ ਜਿਹੜੇ ਆ ਉਹ ਰਲਦੇ ਆ